ਬਸ ਕੁਛ ਨਹੀਂ ਫਰੀ ਹੋ ਗਏ ਅਤੇ ਸੈਲਰੀ ਹੋ ਗਈ ਆਪਣੀ ਸਮਾਨ ਨਹੀਂ ਲੈ ਕੇ ਆਉਣਾ ਘਰ ਦਾ ਘਰ ਦਾ ਸਮਾਨ ਸਾਰਿਆਂ ਬੱਚਿਆਂ ਦੇ ਟੀਫਨ ਵਗੈਰਾ ਨਵੇਂ ਲਿਆਉਣੇ ਆ ਅਤੇ ਰਾਸ਼ਨ ਪਾਣੀ ਚਾਹੀਦਾ ਗੁੜ ਵੀ ਖ਼ਤਮ ਆ ਹੋਰ ਵੀ ਲੈ ਕੇ ਆਉਣਾ ਆਟਾ ਵੀ ਪਿਹਾ ਕੇ ਲਿਆਉਣਾ ਸ਼ੱਕਰ ਵਗੈਰਾ ਸਾਰੇ ਰਾਸ਼ਨ ਦਾਲਾਂ ਵਗੈਰਾ ਖ਼ਤਮ ਹੋਈਆ ਪਈਆਂ ਲੈ ਕੇ ਆਈਏ ਫਿਰ ਆਪਾਂ

ਹਾਂਜੀ ਹਾਂਜੀ ਹਾਂਜੀ ਠੀਕ ਆ

ਮੈਂ ਅੱਜ ਬਣਾਏ ਆਲੂ ਮਟਰ ਨਾਲ ਚਾਵਲ ਹਾਂ ਮੈਂ ਥੋੜ੍ਹਾ ਚਾਵਲ ਵਗੈਰਾ ਵੀ ਹੈ ਨਹੀਂ ਗਾ ਮੈਂ ਸੋਚਦੀ ਸੀ ਆਪਾਂ ਐਤਕੀਂ ਗੱਟਾ ਹੀ ਚੌਲਾਂ ਦਾ ਲੈ ਕੇ

ਹਾਂ ਮੈਂ ਥੋੜ੍ਹਾ ਸਮਾਨ ਵੀ ਲੈਣਾ ਸੀਗਾ ਦਾ ਆਈਬ੍ਰੋ ਧਾਗੇ ਖ਼ਤਮ ਹੋਏ ਪਏ ਆ ਫੇਸ਼ੀਅਲ ਦਾ ਸਮਾਨ ਖ਼ਤਮ ਹੋਇਆ ਪਿਆ ਠੀਕ ਆ ਅਤੇ ਰਾਸ਼ਨ ਪਾਣੀ 'ਚ ਕਾਫੀ ਸਾਰੀਆਂ ਚੀਜ਼ਾਂ ਖ਼ਤਮ ਹੋਈਆਂ ਲੈ ਕੇ ਆਈਏ

ਅਤੇ ਮਿਕਸ ਦਾਲ ਲੈ ਕੇ ਆਉਣੀ ਆ ਮਿਕਸ ਦਾ ਦੇਸੀ ਘਿਓ ਦੇਸੀ ਘਿਓ ਵੀ ਲਿਆਉਣ ਵਾਲਾ ਖ਼ਤਮ ਹੋਇਆ ਪਿਆ ਮਕਾ ਨਾ ਮੱਖਣ ਵੀ ਬਣਾ ਮੱਖਣ ਵੀ ਬਣਾ ਲਵਾਂਗੇ ਮਲਾਈ

ਕਿ ਮਲਾਈ ਲੈ ਕੇ ਆਪਾਂ ਘਿਓ ਕੱਢੀਏ ਘਰ

ਹਾਂਜੀ ਅਤੇ ਹਾਂ ਅਤੇ ਹਾਂ ਅਜਵਾਇਣ ਵਗੈਰਾ ਇਲਾਇਚੀਆਂ ਵਗੈਰਾ ਵੀ ਖ਼ਤਮ ਹੋਈਆਂ ਪਈਆਂ ਉਹ ਵੀ ਲੈ ਕੇ ਆਉਣਾ ਹਾਂਜੀ ਮੈਂ ਪਰਚੀ ਬਣਾ ਕੇ ਰੱਖ ਲੁੰਗੀ ਸਾਰੇ ਸਮਾਨ ਦੀ ਜਦੋਂ ਘਰ ਦਾ ਸੌ ਆਟਾ ਦਾਲ ਚਾਵਲ ਚੀਨੀ ਸਾਰੀ ਚੀਜ਼ ਹਾਂਜੀ ਹਾਂ ਮੈਂ ਸਾਰਾ ਰਾਸ਼ਨ ਪਾਣੀ ਵਿਹਲੇ ਹੋ ਜਾਵਾਂਗੇ ਆਪਾਂ ਲਿਆ ਕੇ ਉੱਥੇ ਅੱਛਾ ਠੀਕ ਹੈ ਜੀ ਅਤੇ ਮੈਂ ਚੰਗਾ ਮੈਂ ਵਿਹਲੀ ਹੋ ਕੇ ਬਹਿ ਜਾਂਦੀ ਹਾਂ ਠੀਕ ਹੈ

ਓਕੇ